ਪੰਜਾਬੀ ਸ਼ਬਦ ਵਿੱਚ ਮੇਰਾ ਸਭ ਤੋਂ ਮਨ ਪਸੰਦ ਜਿਹੜਾ ਵਾਕਾਂਸ਼ ਹੈ ਉਹ ਹੈਗਾ ਅੱਗ ਦੇ ਭਾਅ ਅੱਗ ਦਾ ਭਾਅ ਜਾਂ ਕਹਿ ਲਓ ਅੱਗ ਦੇ ਭਾਅ ਕਿਉਂਕਿ ਅੱਜ ਕੱਲ੍ਹ ਜਿਹੜੀ ਮਹਿੰਗਾਈ ਹੈ ਉਹ ਬਹੁਤ ਹੀ ਜ਼ਿਆਦਾ ਵੱਧਦੀ ਜਾ ਰਹੀ ਹੈ ਅਤੇ ਇੰਨੀ ਤੇਜ਼ੀ ਨਾਲ ਵੱਧ ਰਹੀ ਹੈ ਕਿ ਮਤਲਬ ਇੱਕ ਜਿਹੜਾ ਆਮ ਬੰਦਾ ਹੈਗਾ ਉਹ ਇੱਕ ਬਹੁਤ ਹੀ ਔਖਾ ਹੋ ਰਿਹਾ ਹੈ ਕਿ ਆਪਣਾ ਘਰ ਚਲਾਉਣ ਲਈ ਇਸ ਕਰਕੇ ਇਹ ਮੈਂ ਅਕਸਰ ਵਰਤਦੀ ਹਾਂ ਕਿ ਜਿਹੜੀ ਮਹਿੰਗਾਈ ਹੈ ਤੇ ਇਹਨੇ ਅੱਗ ਹੀ ਲਾਈ ਹੈ ਜਾਂ ਆ ਫਲਾਣੀ ਕੋਈ ਵੀ ਚੀਜ਼ ਲੈ ਲਓ ਆਪਾਂ ਉਹ ਬਹੁਤ ਮਹਿੰਗੀ ਹੈ ਹੈ ਨਾ ਅਤੇ ਇਸ ਕਰਕੇ ਮਤਲਬ ਹਰ ਇੱਕ ਚੀਜ਼ ਲੈ ਲਓ ਤੁਸੀਂ ਸੋਨਾ ਲੈ ਲਓ ਕੱਪੜੇ ਲੈ ਲਓ ਰਾਸ਼ਣ ਲੈ ਲਓ ਸਾਰਾ ਕੁਝ ਬਹੁਤ ਹੀ ਅੱਗ ਦੇ ਭਾਅ ਵਾਂਗੂੰ ਵੱਧ ਰਿਹਾ ਹੈਗਾ ਇਸ ਕਰਕੇ ਇਹ ਬਹੁਤ ਹੀ ਮੇਰਾ ਜਿਹੜਾ ਹੈਗਾ ਅੱਜ ਕੱਲ੍ਹ ਆਮ ਵਰਤਣ ਵਾਲਾ ਸ਼ਬਦ ਹੈ ਅਤੇ ਹਾਂ ਮੈਨੂੰ ਆਪਣੇ ਪੰਜਾਬੀ ਦੇ ਮੁੱਲ ਬੁਲਾਰੇ ਹੋਣ 'ਤੇ ਮਾਣ ਮਹਿਸੂਸ ਹੈ ਕਿਉਂਕਿ ਆਪਾਂ ਪੰਜਾਬੀ ਜਿਹੜੀ ਉਹ ਸਾਡੀ ਇੱਕ ਪ ਪੰਜਾਬ ਦੀ ਇਕ ਮਾਤ ਭਾਸ਼ਾ ਹੈਗੀ ਹੈ ਇਸ ਕਰਕੇ ਮੈਨੂੰ ਇੱਕ ਬਹੁਤ ਮਾਣ ਮਹਿਸੂਸ ਹੁੰਦਾ ਆ ਮੈਨੂੰ ਤਾਂ ਪੰਜਾਬੀ ਬੋਲਣਾ ਬਹੁਤ ਹੀ ਪਸੰਦ ਹੈ ਅਤੇ ਮੈਨੂੰ ਤਾਂ ਦੂਸਰੀਆਂ ਲੈਂਗੁਏਜ ਬਹੁਤ ਘੱਟ ਮਤਲਬ ਆਉਂਦੀਆਂ ਹਨ ਬਟ ਬਹੁਤ ਜਿੰਨੀ ਆਸਾਨੀ ਨਾਲ ਅਸੀਂ ਪੰਜਾਬੀ 'ਚ ਗੱਲ ਕਰ ਸਕਦੇ ਹਾਂ ਅਤੇ ਅਗਲਾ ਬੰਦਾ ਸਮਝ ਸਕਦਾ ਆ ਅਤੇ ਉਹ ਕੋਈ ਹੋਰ ਭਾਸ਼ਾ ਵਿੱਚ ਨਹੀਂ ਹੈ ਇਸ ਕਰਕੇ ਪੰਜਾਬੀ ਜਿਹੜੀ ਹੈਗੀ ਉਹ ਬਹੁਤ ਹੀ ਮਨ ਪਸੰਦ ਭਾਸ਼ਾ ਹੈ